ਟੈਕਨੋਲੋਜੀ ਨੇ ਛੋਟੇ ਕਾਰੋਬਾਰਾਂ ਦੇ ਵਿਕੋ ਵਿਕਾਸ ਵਿੱਚ ਬਹੁਤ ਫਾਇਦਾ ਕੀਤਾ ਹੈ ਅਤੇ ਮਦਦ ਕੀਤੀ ਹੈ ਜਿਵੇਂ ਕਿ ਆਪਾਂ ਪਹਿਲਾਂ ਕੀ ਕਰਦੇ ਸੀਗੇ ਕਰਿਆਨਾ ਲੈਣ ਵੀ ਬਾਜ਼ਾਰ ਜਾਂਦੇ ਸੀ ਹੁਣ ਕੀ ਆਪਾਂ ਇੱਕ ਐਪ ਹੈਗੀ ਹੈ ਆ ਬਲਿੰਕਇਟ ਉਸ ਦੁਆਰਾ ਆਪਾਂ ਛੋਟੀ ਤੋਂ ਛੋਟੀ ਚੀਜ਼ ਵੀ ਘਰ ਬੈਠੇ ਮੰਗਵਾ ਸਕਦੇ ਹਨ ਹੁਣ ਤਾਂ ਐਮਾਜ਼ੋਨ ਫਲਿੱਪਕਾਰਟ ਕਿੰਨੀਆਂ ਚੀਜ਼ਾਂ ਆ ਗਈਆਂ ਜਿਸ ਨਾਲ ਆਪਾਂ ਘਰ ਬੈਠੇ ਕੱਪੜੇ ਘਰ ਦੀ ਕੋਈ ਵੀ ਚੀਜ਼ ਘਰ ਬੈਠੇ ਮੰਗਵਾ ਸਕਦੇ ਹਨ ਮੇਰਾ ਵੀ ਛੋਟਾ ਜਿਹਾ ਕਾਰੋਬਾਰ ਹੈ ਜਿਸ ਵਿੱਚ ਟੈਕਨੋਲੋਜੀ ਨੇ ਬਹੁਤ ਮਦਦ ਕੀਤੀ ਹੈ ਮੈਂ ਆਪਣੇ ਕਾਰੋਬਾਰ ਕਾਰੋਬਾਰ ਦੀ ਗੱਲ ਕਰਦੀ ਹਾਂ ਮੇਰਾ ਕੰਮ ਹੈਗਾ ਵਾ ਬਾਇਡਿੰਗ ਅਤੇ ਪ੍ਰਿੰਟਿੰਗ ਦਾ ਜਿਸ ਵਿੱਚ ਟੈਕਨੋਲੋਜੀ ਨੇ ਮੇਰੀ ਬਹੁਤ ਮਦਦ ਕੀਤੀ ਔਰ ਮੇਰੇ ਬਹੁਤ ਫਾਇਦੇ ਹੋਏ ਹਨ ਪਹਿਲਾਂ ਕੀ ਸੀਗਾ ਮੈਨੂੰ ਆਪ ਸਭ ਕੁਛ ਕਰਨਾ ਪੈਂਦਾ ਸੀ ਪ੍ਰਿੰਟ ਵੀ ਔਰ ਬਾਇਡਿੰਗ ਵੀ ਸਭ ਕਟਿੰਗ ਵਗੈਰਾ ਆਪ ਕਰਨੀ ਪੈਂਦੀ ਹੁਣ ਕੀ ਹੈ ਕਿੰਨੀਆਂ ਮਸ਼ੀਨਾਂ ਆ ਚੁੱਕੀਆਂ ਜਿਸ ਨਾਲ ਲੱਖ ਲੱਖ ਬੁੱਕਸ ਵੀ ਇੱਕੋ ਵਾਰ ਵਿੱਚ ਕੱਟ ਔਫ ਹੋ ਜਾਂਦੀਆਂ ਨੇ ਕਿੰਨਾ ਕੁਛ ਹੋ ਜਾਂਦਾ ਪ੍ਰਿੰਟ ਹੋ ਜਾਂਦਾ ਔਰ ਮੇਰਾ ਇੱਦਾਂ ਟਾਈਮ ਬਚਦਾ ਇਸ ਸਭ ਨਾਲ ਅੱਜ ਕੱਲ੍ਹ ਟੈਕਨੋਲੋਜੀ ਹੀ ਸਭ ਕੁਛ ਹੈਗੀ ਆ ਪਹਿਲਾਂ ਆਪਾਂ ਆਪ ਕਰਦੇ ਸੀਗੇ ਸਭ ਕੁਛ ਪਰ ਸਾਡਾ ਬਹੁਤ ਟਾਈਮ ਵੇਸਟ ਹੁੰਦਾ ਸੀ ਉਸ ਨਾਲ ਹੁਣ ਕੀ ਇੰਨੀਆਂ ਮਸ਼ੀਨਾਂ ਆ ਚੁੱਕੀਆਂ ਵਾ ਇੰਨੀਆਂ ਐਪਸ ਆ ਚੁੱਕੀਆਂ ਵਾ ਆਪਾਂ ਘਰ ਬੈਠ ਕੇ ਖਾਣ ਪੀਣ ਦੀ ਵੀ ਚੀਜ਼ ਮੰਗਵਾ ਸਕਦੇ ਪਹਿਲਾਂ ਕੀ ਸੀ ਸਾਨੂੰ ਜਾਣਾ ਪੈਂਦਾ ਸੀ ਆਪਣਾ ਟਾਈਮ ਵੇਸਟ ਕਰਨਾ ਪੈਂਦਾ ਸੀਗਾ ਜਾ ਕੇ ਔਡਰ ਕਰੋ ਖਾਣ ਲਈ ਫੇਰ ਆਏਗਾ ਹੁਣ ਕੀ ਆ ਘਰ ਬੈਠੇ ਪਹਿਲਾਂ ਜੋਮੈਟੋ ਸਵੀਗੀ ਤੋਂ ਔਡਰ ਕਰੋ ਅਤੇ ਘਰ ਬੈਠੇ ਹੀ ਖਾਣ ਪੀਣ ਦੀ ਚੀਜ਼ ਆ ਜਾਣੀ ਤੁਹਾਡੇ ਤੋਂ ਕਿੰਨਾ ਸਭ ਕੁਛ ਵੇਸਟ ਹੋਣ ਤੋਂ ਬਚਿਆ ਵਾ ਪੈਟਰੋਲ ਜਾਣਾ ਪੈਣਾ ਟਾਈਮ ਵੇਸਟ ਕਿੰਨਾ ਕੁਛ ਆਪਾਂ ਇਸ ਟਾਈਮ ਵਿੱਚ ਕਿੰਨਾ ਕੁਛ ਕਰ ਸਕਦੇ ਹਾਂ ਬਾਕੀ ਚੀਜ਼ਾਂ